ਸਮੇਂ ਦੇ ਨਾਲ਼ ਪੰਜਾਬੀ ਭਾਸ਼ਾ ਦੀ ਵਰਤੋਂ ਬਹੁ ਵਿੱਚ ਬਹੁਤ ਤਬਦੀਲੀ ਆਈ ਹੈ ਇਹ ਭਾਸ਼ਾ ਦਿਨ ਪ੍ਰਤੀ ਦਿਨ ਬਦਲ ਰਹੀ ਹੈ ਇਸ ਭਾਸ਼ਾ ਵਿੱਚ ਹਿੰਦੀ ਇੰਗਲਿਸ਼ ਹੋਰ ਭਾਸ਼ਾਵਾਂ ਦਾ ਵਿਕਾਸ ਹੋਇਆ ਹੈ ਪਹਿਲ ਪਹਿਲੇ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਗਦ ਗੁਰੂ ਸਿੱਖਾਂ ਦੇ ਗੁਰੂਆਂ ਦੇ ਸਮੇਂ ਇਹ ਭਾਸ਼ਾ ਪੈਂਤੀ ਅੱਖਰੀ ਕਹਾਉਂਦੀ ਸੀ ਅਤੇ ਸਮੇਂ ਦੀ ਤਬਦੀਲੀ ਦੇ ਨਾਲ਼ ਹੁਣ ਇਸ ਵਿੱਚ ਫਾਰਸੀ ਭਾਸ਼ਾ ਦੇ ਅੱਖਰ ਸੱਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਫੱਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਨਾ ਐਡ ਹੋ ਜਾਣ ਨਾਲ ਇਹ ਇਸ ਵਰਨਮਾਲਾ ਦੇ ਪ ਅੱਖਰ ਇੱਕਤਾਲ਼ੀ ਹੋ ਗਏ ਹੈ ਹੁਣ ਇਸ ਵਿੱਚ ਫਾਰਸੀ ਭਾਸ਼ਾ ਦੇ ਇਹ ਛੇ ਅੱਖਰ ਵੀ ਜੁੜ ਗਏ ਹਨ ਜਿਸ ਕਰਕੇ ਇਹ ਇਸ ਭਾਸ਼ਾ ਦਾ ਸੱਭਿਆਚਾਰਾ 'ਤੇ ਬਹੁਤ ਪ੍ਰਭਾਵ ਪਿਆ ਹੈ